ਹੈਲੋ ਹੋਰ ਦਵਿੰਦਰ ਜੀ ਕੀ ਹਾਲ ਨੇ ਵਾਹ ਵਧੀਆ ਵਧੀਆ ਵਧੀਆ ਹੋਰ ਸੁਣਾਓ ਵਧੀਆ ਠੀਕ ਠਾਕ ਉਹ ਬਸ ਕੁਦਰਤੀ ਉਹ ਨਾ ਬੱਚੇ ਕਹਿ ਰਹੇ ਤੇ ਤੁਹਾਡੀ ਭਰਜਾਈ ਵੀ ਕਹਿ ਰਹੇ ਸੀ ਵੀ ਸ਼ਿਮਲੇ ਜਾ ਕੇ ਆਉਣਾ ਫਿਰ ਮੇਰੇ ਆ ਗਿਆ ਤੁਹਾਡਾ ਧਿਆਨ ਆ ਮਹਾਂ ਵੀ ਤੁਸੀਂ ਉੱਥੇ ਹੀ ਰਹਿੰਦੇ ਹਾਂ ਕਿਵੇਂ ਕਰੀਏ ਯਾਰ ਅੱਛਾ ਉਹ ਤਾਂ ਠੀਕ ਆ ਹੁਣ ਸਰਦੀ ਬਹੁਤ ਆ ਕਿਵੇਂ ਬਰਫ ਬੁਰਫ ਕੋਈ ਇੱਦਾਂ ਦਾ ਕੋਈ ਕੀ ਸਮਾਨ ਕਿਆ ਲੈ ਕੇ ਆਈਏ ਘਰ ਤੋਂ ਮਾੜਾ ਮੋਟਾ ਖਰਚਾ ਕਿੰਨਾ ਕੁ ਹੋਜੂ

ਬਿਲਕੁਲ ਠੀਕ ਹੈ ਜੀ ਅੱਛਾ ਚਲੋ ਸ਼ੁਕਰ ਆ ਅੱਛਾ ਆਉਣ ਤਾਂ ਜਿਵੇਂ ਹੁਣ ਅਸੀਂ ਨਾ ਇਕੱਤੀ ਦਸੰਬਰ ਦਾ ਸੋਚ ਰਹੇ ਹਾਂ ਵੀ ਇਕੱਤੀ ਦਸੰਬਰ ਉੱਥੇ ਮਨਾ ਲਈਏ ਕੋਈ ਰਸ਼ ਰੁਸ਼ ਕਿਵੇਂ ਹੁੰਦਾ ਮਾੜਾ ਜਿਹਾ ਕੋਈ ਪਾਰਕਿੰਗ ਕਿਵ ਕਿਵੇਂ ਆ ਉੱਥੇ

ਹਾਂ ਹਾਂ ਹਾਂ ਅੱਛਾ ਉਹ ਹਾਂ ਅੱਛਾ ਚਲੋ ਆ ਮੇਰੇ ਧਿਆਨ 'ਚ ਨਹੀਂ ਰਿਹਾ ਉਹ ਮੈਂ ਕਰਦਾ ਭਰਜਾਈ ਨਾਲ ਗੱਲ ਵੀ ਹੈ ਨਾ ਬਈ ਇੱਕ ਦੋ ਦਿਨ ਜੇ ਪਹਿਲਾਂ ਆ ਜੀਏ ਜਾਮ ਲੱਗ ਜਾਂਦਾ ਹਾਂ ਸਹੀ ਆ ਹੋਰ ਬੱਚੇ ਬੱਚੇ ਠੀਕ ਆ ਉਰੇ ਬੱਚੇ ਹੁਣ ਇੱਕ ਤਾਂ ਆਹ ਬੇਟੀ ਤਾਂ ਹੋ ਗਈ ਪੰਜਵੀਂ 'ਚ ਅਤੇ ਬੇਟਾ ਹੈਗਾ ਤੀਜੀ ਦੇ ਵਿੱਚ ਪੜ੍ਹ ਰਹੇ ਹਾਂ ਠੀਕ ਆ

ਅੱਛਾ ਆਹੋ ਮੈਂ ਤੁਹਾਨੂੰ ਫੋਨ ਕਰੂੰਗਾ ਪਹਿਲਾਂ ਵੈਸੇ ਆਉਣ ਤੋਂ ਨਾ ਇੱਕ ਦੋ ਦਿਨ ਪਹਿਲਾਂ ਫੋਨ ਕਰੂੰਗਾ ਅਤੇ ਬਸ ਆਹੀ ਆ ਉਹ ਆਹੀ ਮਨ ਦੇ ਵਿੱਚ ਥੋੜ੍ਹਾ ਡਰ ਜਿਹਾ ਤਾਂ ਮਹਾਂ ਬੱਚੇ ਵੀ ਪਹਿਲਾਂ ਕਦੇ ਮੈਂ ਪਹਾੜੀ ਇਲਾਕੇ ਚ ਲੈਕੇ ਘੱਟ ਗਿਆ ਬਈ ਥੋੜ੍ਹਾ ਜਿਹਾ ਮਨ ਦੇ ਵਿੱਚ ਡਰ ਜਿਹਾ ਤਾਂ ਚਲੋ ਤੁਹਾਡੇ ਨਾਲ ਗੱਲ ਕਰਕੇ ਹੌਸਲਾ ਜਿਹਾ ਮਿਲਿਆ ਅੱਛਾ ਚਲੋ ਠੀਕ ਹੈ ਵੀਰੇ